ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਮ ਮੇਰੇ ਸਕੂਲ ਸਾਡੇ ਸਕੂਲ ਦੇ ਵਿੱਚ ਸਾਰੀਆਂ ਐਕਟੀਵਿਟੀਜ਼ ਅਸੀਂ ਕਰਵਾ ਰਹੇ ਹਾਂ ਦੇਖੋ ਤੁਸੀਂ ਅਗਰ ਤੁਸੀਂ ਸਟੱਡੀ ਦੀ ਗੱਲ ਕਰ ਰਹੇ ਹੋ ਸਟੱਡੀ ਵਾਲੀ ਸਾਈਡ ਤੋਂ ਹੱਟ ਕੇ ਜਿਵੇਂ ਇੰਗਲਿਸ਼ ਸਪੀਕਿੰਗ ਦੇ ਅਸੀਂ ਅਲੱਗ ਤੋਂ ਪੀਰੀਅਡ ਲਗਾ ਰਹੇ ਹਾਂ ਜਿਵੇਂ ਕਿ ਉਹਦੇ ਲਈ ਲਿਸਨਿੰਗ ਸਪੀਕਿੰਗ ਰੀਡਿੰਗ ਰਾਈਟਿੰਗ ਦੇ ਅਲੱਗ ਅਲੱਗ ਸਕੈਜੁਅਲ ਦੇ ਮੋਡੂਲ ਦੇ ਅਕੋਰਡਿੰਗ ਅਸੀਂ ਪੜ੍ਹਾ ਰਹੇ ਹਾਂ ਮਾਰਨਿੰਗ ਇੱਕ ਘੰਟਾ ਜਿਹੜਾ ਉਹਦੇ ਲਈ ਯੂਜ ਕਰਦੇ ਹਾਂ ਅਸੀਂ ਅਸੈਂਬਲੀ ਟਾਈਮ ਅਤੇ ਉਸ ਤੋਂ ਬਾਅਦ ਐਕਸਟਰਾ ਦੇ ਵਿੱਚ ਸਾਡੇ ਕੋਲ ਖੇਡਾਂ ਦੇ ਲਈ ਟਾਈਮ ਅਲੱਗ ਦਿੱਤਾ ਹੋਇਆ ਅੱਧਾ ਘੰਟਾ ਅਸੀਂ ਸਪੈਸ਼ਲ ਕਰ ਰਹੇ ਹਾਂ ਉਹ ਬੱਚਿਆਂ ਦੇ ਲਈ ਜਿਹੜੇ ਬੱਚੇ ਕਿਸੇ ਅਲੱਗ ਅਲੱਗ ਗੇਮ ਦੇ ਵਿੱਚ ਰੁਚੀ ਰੱਖਦੇ ਨੇ ਹਾਂਜੀ ਟਾਈਮਿੰਗ ਸੇਮ ਰਹੇਗੀ ਹੋਰ ਟਾਈਮ ਜ ਜੋ ਹੁੰਦੀ ਹੈ ਸਾਡੀ ਸਵੇਰ ਨੌਂ ਵਜੇ ਤੋਂ ਤਿੰਨ ਵਜੇ ਤੱਕ ਹੈ ਅਤੇ ਜਿਹੜੇ ਐਕਸਟਰਾ ਜਿਵੇਂ ਕਿ ਅਗਰ ਗੇਮਸ ਦੀ ਗੱਲ ਕਰੋ ਤਾਂ ਉਹਦੇ ਲਈ ਤੁਹਾਨੂੰ ਇੱਕ ਘੰਟਾ ਈਵਨਿੰਗ ਟਾਈਮ ਐਕਸਟਰਾ ਲਗਾਣਾ ਪਏਗਾ ਉਹਦੇ ਲਈ ਕੋਰਸ ਜਿਹੜਾ ਉਹ ਅਵੇਲੇਬਲ ਕਰਵਾਉਂਦੇ ਆ ਸਾਡੇ ਇੰਸਟੀਟਿਊਟ ਹੀ ਕਰਵਾਉਂਦਾ ਹੈ ਤੁਹਾਨੂੰ ਅਤੇ ਬਾਕੀ ਜਿਹੜੀਆਂ ਐਕਟੀਵੀਟਿਜ਼ ਨੇ ਉਹ ਅਸੀਂ ਸਕੂਲ ਟਾਈਮ ਦੇ ਵਿੱਚ ਹੀ ਕਰਵਾ ਰਹੇ ਹਾਂ ਅਤੇ ਹਾਂਜੀ ਹਾਂਜੀ ਬਸ ਸੁਵਿਧਾ ਹੈਗੀ ਆ ਸਾਡੀ ਤੁਸੀਂ ਜਿਹੜੇ ਵੀ ਏਰੀਏ ਤੋਂ ਆਉਣਾ ਚਾਹੁੰਦੇ ਹੋ ਉਸ ਏਰੀਏ ਤੋਂ ਤੁਹਾਨੂੰ ਲੈ ਕੇ ਜਾਏਗੀ ਬਸ ਔਰ ਛੱਡ ਕੇ ਵੀ ਜਾਏਗੀ ਸਕੂਲ ਟਾਈਮਿੰਗ ਦੇ ਵਿੱਚ ਹੀ ਹਾਂਜੀ ਅਤੇ ਐਕਸਟਰਾ ਦੇ ਵਿੱਚ ਅਸੀਂ ਜਿਵੇਂ ਡਰਾਇੰਗ ਦੇ ਨਾਲ ਵੀ ਕਈ ਸਾਰੇ ਕੰਪਟੀਸ਼ਨ ਸਾਡੇ ਬੱਚੇ ਜਿੱਤ ਚੁੱਕੇ ਨੇ ਡਰਾਇੰਗ ਦੀਆਂ ਵੀ ਐਕਸਟਰਾ ਕਲਾਸਿਸ ਜਿਹੜੀਆਂ ਨੇ ਉਹ ਲਗਵਾਈਆਂ ਜਾਂਦੀਆਂ ਨੇ ਨਾਲ ਦੇ ਨਾਲ ਮਤਲਬ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਹੋਰ ਚੀਜ਼ਾਂ ਵੀ ਸਿਖਾਈਆਂ ਜਾ ਰਹੀਆਂ ਨੇ ਡਾਂਸ ਕਲਾਸਿਸ ਦਾ ਵੀ ਅਰੇਂਜਮੈਂਟ ਹੈ ਸਪੈਸ਼ਲ ਜਿਹੜੇ ਬੱਚੇ ਮਿਊਜਿਕ ਦੇ ਵਿੱਚ ਇੰਟਰਸਟ ਰੱਖਦੇ ਨੇ ਉਹ ਬੱਚਿਆਂ ਨੂੰ ਮਿਊਜਿਕ ਦੇ ਨਾਲ ਰਿਲੇਟਡ ਵੀ ਅਸੀਂ ਐਕਟੀਵਿਟੀਜ਼ ਕਰਵਾਉਂਦੇ ਹਾਂ ਮਿਊਜਿਕ ਵੀ ਸਿਖਾਇਆ ਜਾ ਰਿਹਾ ਹਾਂਜੀ ਅਤੇ ਸਭ ਦੀ ਕਲਾਸਿਸ ਤਾਂ ਮੈਡਮ ਹੁੰਦੀਆਂ ਹੀ ਨੇ ਦੇਖੋ ਪੂਰੇ ਹਫਤੇ ਦੇ ਵਿੱਚ ਜਿੰਨੀਆਂ ਦਿਨ ਵੀ ਅਲੱਗ ਅਲੱਗ ਹੋਬੀ ਦੇ ਅਕੋਰਡਿੰਗ ਬੱਚਾ ਜਿਹੜਾ ਜਿਹੜੇ ਵੀ ਸਾਈਡ ਵੀ ਜਾਣਾ ਚਾਹੁੰਦਾ ਉਹ ਕਰਵਾ ਕਰ ਸਕਦਾ ਆਪਣੇ ਹੋਬੀ ਦੇ ਅਕੋਰਡਿੰਗ ਉਹੀ ਕਲਾਸ ਅਟੈਂਡ ਕਰ ਸਕਦਾ ਅਤੇ ਬਾਕੀ ਅਸੀਂ ਬੱਚਿਆਂ ਨੂੰ ਕੰਪੀਟੇਟਿਵ ਇਗਜਾਮਜ਼ ਦੇ ਲਈ ਵੀ ਰੈਡੀ ਕਰਵਾ ਰਹੇ ਹਾਂ ਉਹਦੇ ਲਈ ਹੀ ਮਤਲਬ ਜਿਹੜਾ ਕਲਾਸ ਦੇ ਵਿੱਚ ਇਨਵਾਇਰਮੈਂਟ ਇਸ ਤਰੀਕੇ ਦਾ ਅਸੀਂ ਦੇ ਰਹੇ ਹਾਂ ਬੱਚੇ ਨੂੰ ਇਸ ਤਰੀਕੇ ਨਾਲ ਪੜ੍ਹਾਇਆ ਜਾ ਰਿਹਾ ਕਿ ਉਹ ਬੱਚੇ ਜਿਹੜੇ ਨੇ ਕੰਪਟੀਟਿਵ ਇਗਜ਼ਾਮਜ਼ ਦੇ ਲਈ ਰੈਡੀ ਹੋ ਸਕਣ ਸਿਲੇਬਸ ਦੇ ਨਾਲ ਨਾਲ ਉਹਨਾਂ ਨੂੰ ਐਕਸਟਰਾ ਜਿਹੜੀ ਨੋਲੇਜ ਹੈ ਉਹ ਵੀ ਦਿੱਤੀ ਜਾਂਦੀ ਹੈ ਮਤਲਬ ਡੇਲੀ ਦੀ ਲਾਈਫ ਦੇ ਵਿੱਚ ਕਰੰਟ ਅਫੇਅਰਸ ਕੀ ਚਲ ਰਹੇ ਡੇਲੀ ਲਾਈਫ ਦੇ ਵਿੱਚ ਕੀ ਚੱਲ ਰਿਹਾ ਉਹ ਵੀ ਸਾਰਾ ਬੱਚਿਆਂ ਨੂੰ ਦੱਸਿਆ ਜਾਂਦਾ ਜੀ ਠੀਕ ਹੈ ਜੀ ਓਕੇ ਜੀ ਥੈਂਕ ਯੂ